ਜੇ ਤੁਸੀਂ ਦੁਨੀਆਂ ਵਿੱਚ ਕਿੱਥੇ ਵੀ ਯਾਤਰਾ ਕਰ ਸਕਦੇ ਹੋ ਤਾਂ ਤੁਸੀਂ ਕਿੱਥੇ ਜਾਓਗੇ ਅਤੇ ਕਿਉਂ ਜੇ ਮੈਂ ਕਿੱਥੇ ਵੀ ਯਾਤਰਾ ਕਰ ਸਕਦਾ ਹਾਂ ਤਾਂ ਮੈਂ ਜਾਊਂਗਾ ਦੁਬਈ ਕਿਉਂਕਿ ਦੁਬਈ ਵਿੱਚ ਤੁਸੀਂ ਕੁਛ ਵੀ ਕਰ ਸਕਦੇ ਹੋ ਦੁਬਈ ਵਿੱਚ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹਨਾਂ ਕੋਲ ਵੀ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਹੁੰਦੀਆਂ ਹਨ ਦੁਬਈ ਵਿੱਚ ਬਹੁਤ ਸੋਹਣੀ ਸੋਹਣੀ ਬਿਲਡਿੰਗਾਂ ਹੁੰਦੀਆਂ ਹਨ ਉਨ੍ਹਾਂ ਬਿਲਡਿੰਗ ਵਿੱਚ ਇੱਕ ਬਹੁਤ ਮਸ਼ਹੂਰ ਬਿਲਡਿੰਗ ਹੈ ਜਿਹਨੂੰ ਆਪਾਂ ਬੁਰਜ਼ ਖਲੀਫਾ ਕਹਿੰਦੇ ਹਨ ਜਿਹਦੇ ਵਿੱਚ ਵੱਡੇ ਵੱਡੇ ਮੂਵੀਜ਼ ਸਟਾਰ ਜਾਂਦੇ ਹਨ ਬਹੁਤ ਅੰਬਾਨੀ ਜਾਂਦੇ ਹਨ ਅੰਬਾਨੀ ਵਰਗੇ ਲੋਕ ਜਾਂਦੇ ਹਨ ਜੋ ਕਿ ਟ੍ਰਿਲੀਅਨਸ ਹੁੰਦੇ ਹਨ ਜਿਹਨਾਂ ਕੋਲ ਬਹੁਤ ਪੈਸੇ ਹੁੰਦੇ ਹਨ ਅਤੇ ਦੁਬਈ ਵਿੱਚ ਹੋਰ ਖਾਸੀਅਤ ਹੈਗੀ ਉੱਥੋਂ ਦੀਆਂ ਆਲੇ ਦੁਆਲੇ ਦੀ ਮੰਡੀਆ ਜਿੱਦਾਂ ਕਿ ਉੱਥੇ ਇੱਕ ਸੋਨੇ ਦੀ ਮੰਡੀ ਹੈਗੀ ਆ ਜਿਹਦੇ ਵਿੱਚ ਸੋਨਾ ਬਹੁਤ ਸਸਤਾ ਮਿਲਦਾ ਹੈ ਉੱਥੇ ਬਹੁਤ ਵਧੀਆ ਵਧੀਆ ਰੈਸਟੋਰੈਂਟ ਹੈਗੇ ਆ ਦੁਬਈ ਵਿੱਚ ਜਿਹਦੇ ਵਿੱਚ ਬਹੁਤ ਵੱਖਰੇ ਵੱਖਰੇ ਤਰ੍ਹਾਂ ਦਾ ਖਾਣਾ ਮਿਲਦਾ ਜੋ ਕਿ ਲੋਕਾਂ ਨੇ ਕਦੇ ਦੇਖਿਆ ਵੀ ਨਹੀਂ ਹੁੰਦਾ ਕਿਉਂਕਿ ਦੁਬਈ ਵਿੱਚ ਲੋਕ ਦੇਸ਼ ਦੇ ਹਰ ਇੱਕ ਦੇਸ਼ ਤੋਂ ਲੋਕ ਆਉਂਦੇ ਆ ਦੁਬਈ ਵਿੱਚ ਅਤੇ ਉਹ ਆਪਣੇ ਨਾਲ ਆਪਣਾ ਕਲਚਰ ਲੈ ਕੇ ਆਉਂਦੇ ਆਪਣੇ ਨਾਲ ਆਪਣਾ ਖਾਣਾ ਲੈ ਕੇ ਆਉਂਦੇ ਆ ਆਪਣੇ ਨਾਲ ਆਪਣੀ ਸੱਭਿਅਤਾ ਲੈ ਕੇ ਆਉਂਦੇ ਦੁਬਈ ਵਿੱਚ ਇੱਕ ਦੂਜੇ ਨੂੰ ਉਹ ਚੀਜ਼ਾਂ ਸਿਖਾਉਂਦੇ ਹੈਗੇ ਆ ਅਤੇ ਦੁਬਈ ਵਿੱਚ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਂਦੀ ਹੈਗੀ ਆ ਜੋ ਤੁਹਾਨੂੰ ਕਿੱਥੇ ਹੋਰ ਨਹੀਂ ਮਿਲਦੀ ਤੁਹਾਨੂੰ ਦੁਬਈ ਵਿੱਚ ਮਿਲ ਜਾਂਦੀ ਹੈਗੀ ਆ ਹਰ ਇੱਕ ਸਸਤੀ ਮਿਲ ਜਾਂਦੀ ਹੈ ਇਹ 'ਚ ਕਈ ਚੀਜ਼ਾਂ ਬਹੁਤ ਸਸਤੀਆਂ ਜਿੱਦਾਂ ਕਿ ਆਈਫੋਨ ਹੋ ਗਏ ਦੁਬਈ ਵਿੱਚ ਬਹੁਤ ਸਸਤੇ ਆਈਫੋਨ ਮਿਲ ਜਾਂਦੇ ਹਨ ਤੁਸੀਂ ਉਹਨਾਂ ਨੂੰ ਆਪਣੇ ਦੇਸ਼ 'ਚ ਵਾਪਿਸ ਵੀ ਲਿਆ ਸਕਦੇ ਹੋ ਤੁਸੀਂ ਦੁਬਈ ਵਿੱਚ ਬਹੁਤ ਕੁਛ ਕਰ ਸਕਦੇ ਹੋ ਦੁਬਈ ਵਿੱਚ ਤੁਸੀਂ ਪੈਸੇ ਕਮਾਏ ਤੁਸੀਂ ਪੈਸੇ ਕਮਾ ਸਕਦੇ ਹੋ ਦੁਬਈ ਵਿੱਚ ਬਹੁਤ ਪੈਸੇ ਮਿਲਦੇ ਹਨ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਦੇਸ਼ਾਂ ਦੇ ਮੁਕਾਬਲੇ ਜਿਹੜਾ ਦੁਬਈ ਆ ਉਹ ਬਹੁਤ ਹੀ ਵਧੀਆ ਦੇਸ਼ ਹੈਗਾ ਦੁਬਈ ਵਿੱਚ ਬਹੁਤ ਕੰਮ ਕੀਤਾ ਜਾਂਦਾ ਹੈਗਾ ਆ ਲੋਕਾਂ ਦੇ ਦੁਆਰਾ ਅਤੇ ਦੁਬਈ ਹਰ ਦਿਨ ਅੱਗੇ ਵੱਧਦਾ ਜਾ ਰਿਹਾ ਤਾਂ ਜੋ ਕਿ ਮੈਂ ਮੈਨੂੰ ਕਿੱਥੇ ਬਾਹਰ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸਭ ਤੋਂ ਪਹਿਲਾਂ ਦੁਬਈ ਨੂੰ ਹੀ ਚੂਜ ਕਰਾਂਗਾ ਧੰਨਵਾਦ